ਇੱਕ ਮਾਰਚ ਦੋ ਹਜ਼ਾਰ ਤਿੰਨ ਕੱਤੀ ਮਾਰਚ ਦੋ ਹਜ਼ਾਰ ਇੱਕ ਸੱਤ ਮਾਰਚ ਉੱਨੀ ਸੌ ਸਤਾਨਵੇਂ ਪੰਜ ਮਾਰਚ ਦੋ ਹਜ਼ਾਰ ਤੇਈ ਸਤਾਈ ਫਰਵਰੀ ਦੋ ਹਜ਼ਾਰ ਇੱਕ